ਸਾਡੇ ਪਿੰਡਾਂ ਵਿੱਚ ਸੜਕਾਂ ਦੀ ਮੁਰੰਮਤ ਹੋਣ ਵਾਲੀਆਂ ਹਨ ਜਿਸ ਕਾਰਨ ਸਾਨੂੰ ਕਿਤੇ ਵੀ ਜਾਣਾ ਵਾਸਤੇ ਹੌਲੀ ਹੌਲੀ ਜਾਣਾ ਪੈਂਦਾ ਹੈ ਅਤੇ ਜਿਸ ਨਾਲ ਸਾਡੇ ਸੰਦਾਂ ਦੇ ਟਾਇਰਾਂ ਨੂੰ ਨੁਕਸਾਨ ਹੁੰਦਾ ਹੈ ਅਸੀਂ ਸਮੇਂ ਸਿਰ ਨਹੀਂ ਪਹੁੰਚ ਪਾਉਂਦੇ ਹਾਂ ਜੇਕਰ ਕਿਸੇ ਨੇ ਸ਼ਹਿਰ ਵੱਲ ਜਾਣਾ ਹੋਵੇ ਤਾਂ ਸਾਨੂੰ ਮੇਨ ਸੜਕ ਤੱਕ ਪਹੁੰਚਣ ਲਈ ਤੁਰ ਕੇ ਜਾਣਾ ਪੈਂਦਾ ਹੈ ਇੱਥੇ ਕੋਈ ਆਵਾਜਾਈ ਦਾ ਸਾਧਨ ਨਹੀਂ ਹੈ ਜੇਕਰ ਅਸੀਂ ਸ਼ਹਿਰ ਵਿੱਚ ਯਾਤਰਾ ਕਰਨ ਜਾਣਾ ਹੁੰਦਾ ਹੈ ਤਾਂ ਸਾਨੂੰ ਬੱਸਾਂ ਦੀ ਬਹੁਤ ਲੰਬਾ ਸਮਾਂ ਇੰਤਜ਼ਾਰ ਕਰਨਾ ਪੈਂਦਾ ਹੈ ਸਾਡੀਆਂ ਸੜਕਾਂ ਵੀ ਘੱਟ ਚੌੜੀਆਂ ਹਨ ਜਿਸ ਕਾਰਨ ਸੜਕਾਂ 'ਤੇ ਬਹੁਤ ਸਾਰਾ ਭੀੜ ਭੜੱਕਾ ਹੁੰਦਾ ਹੈ ਸ਼ਹਿਰਾਂ ਵਿੱਚ ਵੀ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤਰਨ ਤਾਰਨ ਸ਼ਹਿਰ ਵਿੱਚ ਰਸਤੇ ਬਹੁਤ ਛੋਟੇ ਹੁੰਦੇ ਹਨ ਜਿਸ ਕਰਕੇ ਤੁਰ ਕੇ ਲੰਘਣਾ ਮੁਸ਼ਕਿਲ ਹੋ ਜਾਂਦਾ ਹੈ ਸਰਕਾਰਾਂ ਨੂੰ ਵੱਧ ਤੋਂ ਵੱਧ ਬੱਸ ਸਰਵਿਸ ਦੇਣੀ ਚਾਹੀਦੀ ਹੈ ਅਤੇ ਬੱਸਾਂ ਦਾ ਕਿਰਾਇਆ ਵੀ ਬਹੁਤ ਘੱਟ ਕਰਨਾ ਚਾਹੀਦਾ ਹੈ